ਹਾਂਜੀ ਨਮਸਤੇ ਜੀ ਹੋਰ ਕਿਵੇਂ ਹੋ ਠੀਕ ਠਾਕ ਹੋ ਅੱਛਾ ਹੋ ਗਈ ਵਧੀਆ ਸੈਟਿੰਗ ਅੱਛਾ ਅੱਛਾ ਹਾਂਜੀ ਅੱਛਾ ਅੱਛਾ ਠੀਕ ਹੈ ਜੀ

ਹਾਂ ਕੋਈ ਨਾ ਬਿਲਕੁਲ ਇਹ ਵੈਸੇ ਤਾਂ ਮੁਕਤਸਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਯਾਨੀ ਇਹਦੀ ਹਾਂ ਜੀ ਅਤੇ ਮਤਲਬ ਕਿ ਉੱਧਰ ਆਪਣੇ ਬੈਂਕ ਰੋਡ 'ਤੇ ਵੀ ਹੈਗੀਆ ਇੱਕ ਦੋ ਦੁਕਾਨਾਂ ਵਧੀਆ ਨੇ ਉੱਥੋਂ ਵਧੀਆ ਮਿਲ ਜਾਂਦੇ ਨੇ ਇੱਧਰ ਕੋਟਕਪੂਰਾ ਰੋਡ 'ਤੇ ਵੀ ਹਾਂਜੀ ਹਾਂ ਇੱਥੇ ਇੱਕ ਮੌਲ ਹੈ ਬਹੁਤ ਵੱਡਾ ਉੱਥੋਂ ਹੀ ਵਧੀਆ ਮਿਲ ਜਾਂਦੇ ਨੇ ਬਾਕੀ ਜੇ ਕੋਈ ਪਸ਼ਮ ਪੁਸ਼ਮ ਵੀ ਲੈਣੀ ਆ ਤੁਸੀਂ ਮੈਂ ਵੀ ਬੁਣਦੀ ਹਾਂ ਮੇਰੇ ਤੋਂ ਵੀ ਤੁਸੀਂ ਲੈ ਸਕਦੇ ਹੋ ਕੋਈ ਹਾਂਜੀ ਹਾਂ ਮੈਂ ਬੁਣਦੀ ਹਾਂ ਹਾਂ ਕੋਈ ਵੀ ਕੋਈ ਜੈਕਟ ਵਗੈਰਾ ਕੋਟੀ ਮਫਲਰ ਜੋ ਵੀ ਆ ਅਤੇ ਬਾਕੀ ਜੇ ਜੇ ਤੁਹਾਨੂੰ ਬਾਹਲੀ ਅਮਰਜੈਂਸੀ ਆ ਤਾਂ ਉੱਥੇ ਆਪਣੇ ਥਾਣੇ ਦੇ ਕੋਲ ਇੱਕ ਬਹੁਤ ਵਧੀਆ ਪਸ਼ਮ ਦੀ ਦੁਕਾਨ ਹੈ ਹਾਂਜੀ ਉੱਥੋਂ ਘਰ ਦੀਆਂ ਬੁਣੀਆਂ ਹੋਈਆ ਜੈਕਟਾਂ ਵਗੈਰਾ ਮਿਲ ਜਾਂਦੀਆਂ ਨੇ ਵਧੀਆ ਐਨ ਹਾਂ ਹਾਂਜੀ ਹਾਂਜੀ ਹਾਂ ਨਹੀਂ ਕੋਈ ਨਾ ਹਾਂਜੀ ਹਾਂ ਹਾਂ ਹਾਂ ਨਹੀਂ ਲੋਅਰ ਵਗੈਰਾ ਉੱਥੋਂ ਮਿਲ ਜਾਂਦੀਆਂ ਨੇ ਕੋਟਕਪੂਰਾ ਰੋਡ ਤੋਂ ਬਹੁਤ ਵਧੀਆ ਦੁਕਾਨਾਂ ਹੈਗੀਆਂ ਨੇ ਉੱਥੇ ਹਾਂਜੀ ਹਾਂ ਹਾਂ ਕੋਈ ਨਾ ਤੁਸੀਂ ਦੇਖ ਲਓ ਹਾਂ ਹਾਂ ਦੀਦੀ ਹਾਂਜੀ ਹਾਂ ਕੋਈ ਨਾ ਦੱਸ ਦਿਓ ਮੈਨੂੰ ਚਲ ਵੜਾਗੇ ਟਾਈਮ ਕੱਢ ਲਵਾਂਗੇ ਹਾਂ ਹਾਂ ਹਾਂ ਤੁਸੀਂ ਮੈਨੂੰ ਕਾਲ ਕਰ ਦਿਓ ਸ਼ਾਮ ਨੂੰ ਵੀ ਕਦੋਂ ਜਾਣਾ ਕੱਲ੍ਹ ਨੂੰ ਜਾਣਾ ਜਾਂ ਜਦੋਂ ਵੀ ਹਾਂ ਹਾਂਜੀ ਹਾਂ ਮੈਂ ਜਾ ਵੜਾਂਗੀ ਤੁਹਾਡੇ ਨਾਲ ਅੱਛਾ ਅੱਛਾ ਅੱਛਾ ਹਾਂਜੀ ਹਾਂ ਹਾਂ ਹਾਂਜੀ ਹਾਂ ਕੋਈ ਨਹੀਂ ਮੈਂ ਫਿਰ ਲਿਆਉਂਦੀ ਰਹਿੰਦੀ ਨਾ ਜੀ ਪਸ਼ਮ ਪੁਸ਼ਮ ਤਾਂ ਕਰਕੇ ਫਿਰ ਸਾਰੀਆਂ ਦੁਕਾਨਾਂ ਬਾਰੇ ਪਤਾ ਰੱਖਣਾ ਪੈਂਦਾ ਹੈਗਾ ਹਾਂ ਤਾਂ ਹਾਂਜੀ ਹਾਂ ਹਾਂ ਹਾਂ ਹਾਂਜੀ ਹਾਂ ਹਾਂ ਕੋਈ ਨਾ ਜਾ ਵੜਾਂਗੀ ਮੈਂ ਤੁਹਾਡੇ ਨਾਲ ਦੱਸ ਦਿਓ ਮੈਨੂੰ ਤੁਸੀਂ ਹਾਂ ਦਿਵਾ ਲਿਆਵਾਂਗੇ ਕੋਈ ਨਾ ਜੀ ਹਾਂਜੀ ਹਾਂ ਕੋਈ ਨਾ ਦਿਵਾ ਲਿਆਵਾਂਗੇ ਜੀ ਬਹੁਤ ਵਧੀਆ ਦੁਕਾਨ ਹੈਗੀ ਉੱਥੇ ਇੱਕ ਹਾਂਜੀ ਹਾਂ ਉਹ ਫਿਰ ਭੀੜੀ ਗਲੀ ਦੇ ਵਿੱਚ ਸਾਰੀਆਂ ਦੁਕਾਨਾਂ ਨੇ ਜੀ ਉਹ ਉੱਥੋਂ ਟੋਪੀ ਵਗੈਰਾ ਵੀ ਮਿਲ ਜਾਂਦੀਆਂ ਹੈਗੀਆਂ ਅਤੇ ਪਸ਼ਮ ਵਾਲਿਆਂ ਕੋਲ ਵੀ ਇੱਕ ਅੰਟੀ ਨੇ ਉਹ ਵੀ ਬਹੁਤ ਵਧੀਆ ਬੁਣਦੇ ਹੈਗੇ ਉੱਥੋਂ ਵੀ ਮਿਲ ਜਾਂਦੀਆਂ ਨੇ ਹਾਂ ਹਾਂਜੀ ਹਾਂ ਮਿਲ ਜਾਂਦੇ ਨੇ ਸ਼ਾਲ ਮਿਲ ਜਾਂਦੇ ਨੇ ਹਾਂਜੀ ਹਾਂ ਨਹੀਂ ਕੋਈ ਨਹੀਂ ਕੋਈ ਨਹੀਂ ਸਾਰੀਆਂ ਚੀਜ਼ਾਂ ਦਿਵਾ ਲਿਆਉਂਗੀ ਠੀਕ ਠੀਕ ਹੈ ਜੀ ਦੱਸ ਦਿਓ ਫਿਰ ਜਦੋਂ ਜਾਣਾ ਹੋਇਆ ਮੈਂ ਚਲ ਵੜਾਂਗੀ ਤੁਹਾਡੇ ਨਾਲ ਹਾਂ ਮੈਨੂੰ ਪਤਾ ਹੀ ਹੈ ਜੀ ਸਾਰੀਆਂ ਦੁਕਾਨਾਂ ਬਾਰੇ ਹਾਂਜੀ ਹਾਂ ਠੀਕ ਹੈ ਜੀ ਓਕੇ